ਸਤਿ ਸ਼੍ਰੀ ਅਕਾਲ ਮੈਨੂੰ ਅੱਜ ਕੱਲ੍ਹ ਦੇ ਜੇ ਗਾਣਿਆਂ ਦੀ ਗੱਲ ਕਰੀਏ ਤਾਂ ਮੈਨੂੰ ਅੱਜ ਕੱਲ੍ਹ ਦੇ ਗਾਣੇ ਇੰਨੇ ਕੁਝ ਖ਼ਾਸ ਪਸੰਦ ਨਹੀਂ ਹੈਗੇ ਕਿਉਂਕਿ ਅੱਜ ਕੱਲ੍ਹ ਦੇ ਜਿਹੜੇ ਗਾਇਕਾਰ ਆ ਉਹ ਬਹੁਤ ਜ਼ਿਆਦਾ ਹੀ ਧੜਕਾ ਵੜਕਾ ਗਾਣੇ ਗਾਉਂਦੇ ਆ ਵਾਰਦਾਤਾਂ ਨੂੰ ਲੈ ਕੇ ਗਾਣੇ ਗਾਉਂਦੇ ਆ ਜੋ ਕਿ ਗੈਂਗਸਟਰਾਂ ਨੂੰ ਲੈ ਕੇ ਗਾਣੇ ਗਾਉਂਦੇ ਆ ਜੋ ਕਿਉਂਕਿ ਮੈਨੂੰ ਬਿਲਕੁਲ ਪਸੰਦ ਨਹੀਂ ਮੈਨੂੰ ਜੋ ਪਸੰਦ ਸੀਗੇ ਉਹ ਥੋੜ੍ਹੇ ਪੁਰਾਣੇ ਟਾਈਮ ਦੇ ਜਿਹੜੇ ਗਾਇਕਾਰ ਸੀਗੇ ਉਹਨਾਂ ਦੇ ਗਾਣੇ ਜਿੱਦਾਂ ਗੁਰਦਾਸ ਮਾਨ ਆ ਬੱਬੂ ਮਾਨ ਉਹਨਾਂ ਦੇ ਗਾਣੇ ਥੋੜ੍ਹੇ ਜ਼ਿਆਦਾ ਵਧੀਆ ਲੱਗਦੇ ਸੀਗੇ ਬਟ ਹੁਣ ਜੇ ਹੁਣ ਦੇ ਗਾਇਕਾਰ ਜਿਹੜੇ ਹੈਗੇ ਆ ਉਹ ਬਹੁਤ ਜ਼ਿਆਦਾ ਲੜਾਈ ਝਗੜੇ ਨੂੰ ਲੈ ਕੇ ਬਹੁਤ ਜ਼ਿਆਦਾ ਮਤਲਬ ਬਹੁਤ ਜ਼ਿਆਦਾਤਰ ਲੜਾਈ ਝਗੜੇ ਨੂੰ ਲੈ ਕੇ ਹੀ ਗਾਣੇ ਗਾਉਂਦੇ ਜਿਹੜੇ ਮੈਨੂੰ ਪਸੰਦ ਨਹੀਂ ਆਉਂਦੇ